ਹੈਲੋ ਹਾਂਜੀ ਹਾਂਜੀ ਬੋਲੋ

ਹਾਂਜੀ ਹਾਂਜੀ ਸਰ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਇੱਥੇ ਦੇਖ ਸਕਦੇ ਜੇ ਅੰਮ੍ਰਿਤਸਰ ਆਓਗੇ ਨਾ ਤਾਂ ਡੇਢ ਕਿਲੋਮੀਟਰ ਦੂਰ ਆ ਗੋਲਡਨ ਟੈਂਪਲ ਤੋਂ ਮਹਾਰਾਜਾ ਰਣਜੀਤ ਸਿੰਘ ਮਿਊਜੀਅਮ ਬਣਿਆ ਹੋਇਆ ਨਾ ਅਤੇ ਇਸ ਇਹਨਾਂ ਦੇ ਨਾਂ 'ਤੇ ਹੀ ਜੇ ਜਿਹਦੇ ਵਿੱਚ ਨਾ ਇਹਨਾਂ ਦੀਆਂ ਸਾਰਾ ਇਹ ਦੱਸਿਆ ਹੋਇਆ ਵਾ ਅਤੇ ਪਿਕਚਰਾਂ ਦਿਖਾਈਆਂ ਹੋਈਆ ਫੋਟੋਆਂ ਜ਼ਿਆਦਾ ਦਿਖਾਈਆਂ ਹੋਈਆਂ ਨਾਲੇ ਉਹਦੇ ਵਿੱਚ ਦੱਸਿਆ ਹੋਇਆ ਕਿਸ ਤਰ੍ਹਾਂ ਨਾਲ ਜੰਗਾਂ ਲੜੀਆਂ ਜਾਂ ਕਿਸ ਤਰ੍ਹਾਂ ਦਾਨ ਕਰਦੇ ਹੁੰਦੇ ਸੀ ਹੈ ਨਾ ਫਿਰ ਇੱਕ ਰਾਮਬਾਗ ਗਾਰਡਨ ਇਹਨਾਂ ਦੇ ਨਾਂ 'ਤੇ ਬਣਿਆ ਹੋਇਆ ਜਿੱਥੇ ਬੱਚਿਆਂ ਦੇ ਲਈ ਝੂਲੇ ਝਾਲੇ ਲਾਏ ਆ ਸਾਰਾ ਪਾਰਕਿੰਗ ਸੈੱਟ ਕੀਤੀ ਹੋਈ ਆ ਇਕ ਅਟਾਰੀ ਰੋਡ ਵੱਲ ਆਪਾਂ ਅਟਾਰੀ ਤਾਂ ਸੁਣਿਆ ਨਾ ਬਾਰਡਰ ਅਟਾਰੀ ਵੱਲ ਜਾਓਗੇ ਰਸਤੇ ਵਿੱਚ ਇੱਕ ਕੰਜਰੀ ਪੁਲ ਆਉਂਦਾ ਇਹਨਾਂ ਦੇ ਨਾਮ 'ਤੇ ਉਹ ਇਹਨਾਂ ਦਾ ਇਹਨਾਂ ਨਾਲ ਰਿਲੇਟਿਡ ਪਲੇਸ ਇੱਕ ਸਥਾਨ ਬਣਿਆ ਹਾਂਜੀ ਫਿਰ ਇੱਕ ਗੋਬਿੰਦਗੜ੍ਹ ਫੋਰਟ ਹੈਗਾ ਇਹਨਾਂ ਦਾ ਗੋਬਿੰਦਗੜ ਕਿਲ੍ਹਾ ਜਿਹਨੂੰ ਆਪਾਂ ਕਹਿ ਲਓ ਅਤੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਿਡ ਆ ਉੱਥੇ ਤੁਸੀਂ ਘੁੰਮ ਸਕਦੇ ਜੇ ਬਹੁਤ ਵਧੀਆ ਉਹ ਜਗ੍ਹਾ ਵਾ ਉੱਥੇ ਇਹਨਾਂ ਦੇ ਰਿਲੇਟਿਡ ਸਿੱਕੇ ਪਏ ਹੋਏ ਨੇ ਕਿਰਪਾਨਾਂ ਨੇ ਇਹਨਾਂ ਦੇ ਜੋ ਹਥਿਆਰ ਵਰਤਦੇ ਸੀਗੇ ਆਪਣੇ ਜੰਗਾਂ ਯੁੱਧਾਂ ਵਿੱਚ ਵੀ ਉਹ ਵੀ ਪਏ ਨੇ ਇਹਨਾਂ ਦੀਆਂ ਹਾਂਜੀ ਹਾਂਜੀ ਪੇਂਟਿੰਗਾਂ ਨੇ ਇਹਨਾਂ ਦੀਆਂ ਜੋ ਬਣੀਆਂ ਹੋਈਆਂ ਨੇ ਉੱਥੇ

ਤਾਂ ਠੀਕ ਆ ਸਰ ਤੁਸੀਂ ਆਇਓ ਅਤੇ ਮੈਂ ਤੁਹਾਨੂੰ ਘੁੰਮਾਉਣ ਲਈ ਖੜਾਂਗਾ ਹਾਂਜੀ ਠੀਕ ਆ ਓਕੇ